ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੱਖ ਇਤਿਹਾਸ ਬਹੁਤ ਹੀ ਡੂੰਘਾ ਸਮੁੰਦਰ ਦੀ ਤਰ੍ਹਾਂ ਹੈਗਾ ਇਹ ਜਿਹੜੀ ਜਾਣੀ ਕਿ ਇਹਨਾਂ ਦੇ ਬਾਰੇ ਬਹੁਤ ਹੀ ਡੂੰਘਾਈ 'ਚ ਜਾਣਾ ਪੈਂਦਾ ਹੈਗਾ ਬੜੀ ਸਿੱਖੀ 'ਤੇ ਸਿੱਖੀ ਦੇ ਉੱਤੇ ਕਾਫੀ ਲੰਮੀ ਚੌੜੀ ਕਹਾਣੀਆਂ ਨੇ ਜਿਹੜਾ ਕਿ ਤੁਸੀਂ ਜਾਉ ਕਦੇ ਦਰਬਾਰ ਸਾਹਿਬ ਜਾਉ ਉੱਥੇ ਗੁਰੂ ਗੋ ਚੌਥੇ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖੀ ਅਤੇ ਸਰੋਵਰ ਬਣਾਇਆ ਬਾਬੇ ਬਾਬਾ ਬੁੱਢਾ ਜੀ ਦੇ ਨਾਲ ਉਨ੍ਹਾਂ ਦੀ ਮਦਦ ਲਈ ਬਾਬਾ ਬੁੱਢਾ ਜੀ ਨੇ ਅਤੇ ਉਸ ਤੋਂ ਬਾਅਦ ਦਸ ਗੁਰੂ ਆਏ ਦਸਾਂ ਗੁਰੂਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦਾ ਜਨਮ ਪਟਨਾ ਸਾਹਿਬ ਦਾ ਹੋਇਆ ਉਸ ਤੋਂ ਬਾਅਦ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਤੋਂ ਬਾਅਦ ਇਹ ਆਨੰਦਪੁਰ ਸਾਹਿਬ ਆ ਕੇ ਨੰਦਾ ਦੀ ਬਸ ਨੰਦਾ ਦੀ ਵ ਨੰਦਾ ਦੀ ਨਗਰੀ ਦੇ ਵਿੱਚ ਵਸੇ ਅਤੇ ਇੱਥੋਂ ਫਿਰ ਇਨ੍ਹਾਂ ਦੇ ਚਾਰ ਸਾਹਿਬਜ਼ਾਦੇ ਸੀਗੇ ਫੇਰ ਮੁਗਲਾਂ ਨੇ ਇਨ੍ਹਾਂ ਨੂੰ ਘੇਰਾ ਕੱਸਿਆ ਅਤੇ ਉਹ ਤੋਂ ਬਾਅਦ ਫਿਰ ਇਨ੍ਹਾਂ ਦਾ ਖੇਰੂੰ ਖੇਰੂੰ ਹੋ ਗਿਆ ਪਰਿਵਾਰ ਅਤੇ ਉਸ ਤੋਂ ਬਾਅਦ ਗੱਲ ਇਹ ਹੈ ਵੀ ਇਤਿਹਾਸ ਬਹੁਤ ਲੰਬਾ ਹੈਗਾ ਇਸ ਨੂੰ ਐਂ ਫੋਨ 'ਤੇ ਗੱਲ ਨਹੀਂ ਚੱਲਦੀ ਇੱਕ ਦਿਨ ਇਕੱਠੇ ਹੋ ਕੇ ਸੰਗਤ ਦੇ ਵਿੱਚ ਬੈਠਾਂਗੇ ਅਤੇ ਨਾਲੇ ਸਾਰਾ ਪ੍ਰਚਾਰ ਗੁਰੂ ਦੇ ਬਾਰੇ ਸਾਰੀ ਜਾਣਕਾਰੀ ਸਿੱਖੀ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੀ ਜੀ ਠੀਕ ਹੈ

ਵਾਏ